ਮੈਂ ਪੰਜਾਬ ਦਾ ਰਹਿਣ ਵਾਲਾ ਹਾਂ ਮੇਰਾ ਨਾਮ ਰੋਹਿਤ ਕੁਮਾਰ ਹੈ ਮੈਂ ਵੱਖ ਵੱਖ ਭਾਸ਼ਾਵਾਂ ਵਿੱਚ ਗਾਉਣ ਦੀ ਹਮੇਸ਼ਾ ਕੋਸ਼ਿਸ਼ ਕਰਦਾ ਰਹਿੰਦਾ ਹਾਂ ਮੈਂ ਬਚਪਨ ਤੋਂ ਹੀ ਮੈਨੂੰ ਗੀਤ ਗਾਉਣ ਦਾ ਦੇ ਵੱਖ ਵੱਖ ਭਾਸ਼ਾ ਭਾਸ਼ਾਵਾਂ ਵਿੱਚ ਗਾਉਣ ਦਾ ਬਹੁਤ ਸ਼ੌਕ ਸੀ ਮੈਂ ਆਪਣੇ ਉਸਤਾਦ ਰੋਬਿਨ ਸਿੰਘ ਜੀ ਕੋਲੋਂ ਬਚਪਨ ਤੋਂ ਹੀ ਸਿੱਖਦਾ ਆ ਰਿਹਾ ਹਾਂ ਮੈਂ ਪਹਿਲਾਂ ਤਾਂ ਪੰਜਾਬੀ ਭਾਸ਼ਾ ਵਿੱਚ ਅਤੇ ਵੋਕਲ ਸੋਂਗ ਹੋ ਗਏ ਜਾਂ ਨਵੀਂ ਨਵੀਂ ਤਕਨੀਕਾਂ ਨਾਲ ਗਾਉਣ ਦੀ ਕੋਸ਼ਿਸ਼ ਕਰਦਾ ਸੀ ਪਰ ਹੁਣ ਹੌਲੀ ਹੌਲੀ ਮੈਂ ਹਿੰਦੀ ਭਾਸ਼ਾ ਦਾ ਵੀ ਅਭਿਆਸ ਕਰਦਾ ਹਾਂ ਅਤੇ ਹਿੰਦੀ ਗਾਣਿਆਂ ਨੂੰ ਵੀ ਆਪਣਾ ਹਿੰਦੀ ਗਾਣਿਆਂ ਨੂੰ ਵੀ ਆਪਣਾ ਸ਼ੌਕ ਬਣਾਇਆ ਹੋਇਆ ਮੈਂ ਜਦੋਂ ਵੀ ਹਿੰਦੀ ਗਾਣੇ ਹਿੰਦੀ ਗਾਣੇ ਗਾਉਂਦਾ ਹਾਂ ਤਾਂ ਮੇਰੇ ਉਸਤਾਦ ਜੀ ਮੇਰੀ ਬਹੁਤ ਮਦਦ ਕਰਦੇ ਹਨ ਪੰਜਾਬੀ ਗਾਣੇ ਮੇਰੀ ਮਾਂ ਬੋਲੀ ਹੈ ਪੰਜਾਬੀ ਇਸ ਕਰਕੇ ਮੈਂ ਪੰਜਾਬੀ ਗਾਣੇ ਜ਼ਿਆਦਾ ਪਸੰਦ ਗਾਉਣਾ ਕਰਦਾ ਹਾਂ ਪਰ ਮੈਂ ਹਿੰਦੀ ਗਾਣਿਆਂ ਨੂੰ ਵੀ ਪਹਿਲ ਦੇਣ ਦੀ ਕੋਸ਼ਿਸ਼ ਕਰ ਰਿਹਾ ਹਾਂ ਕਿਉਂਕਿ ਹਿੰਦੀ ਗਾਣੇ ਮੈਂ ਹੌਲੀ ਹੌਲੀ ਸਿੱਖ ਰਿਹਾ ਹਾਂ ਮੈਂ ਤਬਲੇ 'ਤੇ ਜਾਂ ਹਰਮੋਨੀਅਮ 'ਤੇ ਜ਼ਿਆਦਾਤਰ ਗਾਉਣ ਦੀ ਕੋਸ਼ਿਸ਼ ਕਰਦਾ ਹਾਂ ਕਿਉਂਕਿ ਹਰਮੋਨੀਅਮ ਨਾਲ ਮੈਨੂੰ ਰਿਆਜ਼ ਕਰਨ ਵਿੱਚ ਕਾਫੀ ਮਦਦ ਮਿਲਦੀ ਹੈ ਅਤੇ ਮੈਨੂੰ ਹੌਲੀ ਹੌਲੀ ਸੁਰਾਂ ਦਾ ਕਾਫੀ ਗਿਆਨ ਹੋ ਗਿਆ ਹੈ